ਖੂਹ 'ਚੋਂ ਪਾਣੀ ਜਿਵੇਂ ਕਿ ਲੋਕ ਪਹਿਲੇ ਸਮਿਆਂ ਵਿੱਚ ਖੂਹ 'ਚੋਂ ਪਾਣੀ ਕੱਢਦੇ ਸੀ ਬਾਲਟੀ ਪਾ ਕੇ ਵਿੱਚ ਰੱਸੀ ਨਾਲ਼ ਬੰਨ੍ਹ ਕੇ ਬਾਲਟੀ ਨੂੰ ਫਿਰ ਉਹ ਰੱਸੀ ਨੂੰ ਖਿੱਚਦੇ ਸੀ ਕਿੰਨੀ ਮਿਹਨਤ ਕਰਨੀ ਪੈਂਦੀ ਸੀ ਟਾਈਮ ਵੀ ਕਿੰਨਾਂ ਲੱਗਦਾ ਸੀ ਪਰ ਅੱਜ ਕੱਲ੍ਹ ਟੈਕਨੋਲਜੀ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਨੂੰ ਇਹਦੇ ਬਹੁਤ ਸਾਰੇ ਵਾਧੇ ਹਨ ਅੱਜ ਕੱਲ੍ਹ ਲੋਕ ਇਲੈਕਟ੍ਰਿਕ ਮੋਟਰਸ ਜਿਵੇਂ ਕਿ ਮੱਛੀ ਮੋਟਰ ਟੁੱਲੂ ਪੰਪ ਇਹ ਸਭ ਆ ਗਏ ਨੇ ਇਹਨੂੰ ਜ਼ਮੀਨ ਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ ਅਤੇ ਅਤੇ ਪਾਣੀ ਇਹ ਖੁਦ ਪਾਣੀ ਖਿੱਚ ਲੈਂਦੇ ਇਹਦੇ ਨਾਲ਼ ਪਾਣੀ ਟਾਈਮ ਵੀ ਸੇਵ ਹੁੰਦਾ ਹੈ ਲੋਕਾਂ ਦਾ ਕਿਉਂਕਿ ਅੱਜ ਕੱਲ੍ਹ ਲੋਕ ਕਿਸੇ ਕੋਲ ਇੰਨਾਂ ਟਾਈਮ ਨਹੀਂ ਹੈਗਾ ਅਤੇ ਟੈਕਨੋਲੋਜੀ ਦਾ ਵੀ ਇੰਨੀ ਕੁ ਜ਼ਿਆਦਾ ਵੱਧ ਗਈ ਹੈ ਕਿ ਲੋਕਾਂ ਨੂੰ ਇਹਦਾ ਸਾਨੂੰ ਇਹਦਾ ਸਹੀ ਪ੍ਰਯੋਗ ਵੀ ਕਰਨਾ ਚਾਹੀਦਾ ਹੈ ਸਾਡੇ ਲਈ ਹੀ ਫਾਇਦੇਮੰਦ ਹੈ ਅੱਜ ਕੱਲ੍ਹ ਲੋਕ ਕੰਮਾਂ ਕਾਰਾਂ ਵਿੱਚ ਜ਼ਿਆਦਾ ਰੁਝਾਨ ਰੱਖਦੇ ਹਨ ਅਤੇ ਕਿਸੇ ਕੋਲ ਇੰਨਾਂ ਟਾਈਮ ਹੁੰਦਾ ਨਹੀਂ ਹੈ ਇਸ ਕਰਕੇ ਲੋਕਾਂ ਨੇ ਇਲੈਕਟ੍ਰਿਕ ਮੋਟਰਸ ਦਾ ਯੂਜ ਕਰਦੇ ਨੇ ਅਤੇ ਇਹਦੇ ਨਾਲ਼ ਵਾਧਾ ਹੁੰਦਾ ਆ ਕਿ ਟਾਈਮ ਸੇਵ ਹੁੰਦਾ ਆ ਸਭ ਦਾ